ਵੀ ਜਿਹੜੇ ਰੰਗ ਆ ਇਹ ਵੀ ਰੰਗ ਕਲਰ ਜਿਹੜੇ ਹੈਗੇ ਮੈਂ ਆਪਦੇ ਦਿਮਾਗ ਨਾਲ ਅਤੇ ਆਪਦੇ ਦਿਮਾਗ ਨਾਲ ਹੀ ਚੁਣਦੀ ਹਾਂ ਮੈਂ ਫਿੱਕੇ ਕਲਰ ਵੀ ਪਸੰਦ ਆ ਆਉਂਦੇ ਆ ਮੈਨੂੰ ਤਾਂ ਦੇ ਬਾਹਲੇ ਫਿੱਕੇ ਕਲਰ ਹੀ ਪਸੰਦ ਆ ਪਸੰਦ ਹੈਗੇ ਅਤੇ ਫਿੱਕੇ ਕਲਰ ਹੀ ਪਾਉਂਦੀ ਹਾਂ ਫਿੱਕੇ ਕਲਰ ਜਿਹੜੇ ਹੁੰਦੇ ਨੇ ਉਹ ਜਦੋਂ ਮਰਜ਼ੀ ਆ ਪਾਏ ਜਾਣ ਇਹ ਗੱਲ ਨਹੀਂ ਵੀ ਜਿਹੜੇ ਵੀ ਰੈਡ ਆ ਜਾਂ ਹਰਾ ਕਲਰ ਆ ਮਿਲਾ ਕੇ ਅਤੇ ਉਹ ਆਪ ਨੂੰ ਨਹੀਂ ਚੰਗੇ ਲੱਗਦੇ ਪਾਏ ਵੀ ਗੂੜ੍ਹੇ ਗੂੜ੍ਹੇ ਕਲਰ ਫਿੱਕੇ ਹੋਣ ਚਲ ਇੱਕ ਕਲਰ ਫਿੱਕਾ ਹੋਵੇ ਭਾਵੇਂ ਸ਼ਰਟ ਦਾ ਹੋਵੇ ਸਲਵਾਰ ਦਾ ਹੋਵੇ ਇੱਕ ਕਲਰ ਫਿੱਕਾ ਹੋਣਾ ਚਾਹੀਦਾ ਮੈਂ ਜਿਹੜੇ ਕਲਰ ਪਾਉਂਦੀ ਹਾਂ ਮੈਂ ਆਪਦੇ ਜਾਂ ਪੈਰਟ ਜਾਂ ਰੈਡ ਕਲਰ ਜਾਂ ਫਿੱਕਾ ਪਿੰਕ ਅਤੇ ਜਾਂ ਫਿੱਕਾ ਸਤਰੰਗੀ ਵੀ ਜਿਹੜੇ ਬਾਹਲੇ ਪਾਏ ਵੀ ਭੈੜੇ ਵੀ ਨਾ ਲੱਗਣ ਅਤੇ ਅੱਖਾਂ ਜਿਹੀਆ 'ਚ ਵੀ ਨਾ ਵੱਜਣ ਫਿੱਕੇ ਕਲਰ ਪਾਉਣੇ ਪਸੰਦ ਆ ਅਤੇ ਆਪਦੇ ਦਿਮਾਗ ਰਾਹੀਂ ਮੈਂ ਜੋ ਲੈਂਦੀ ਹਾਂ ਮੈਂ ਫਿੱਕੇ ਕਲਰ ਹੀ ਲੈਂਦੀ ਪਾਉਂਦੀ ਹਾਂ ਤਾਂ ਫਿੱਕੇ ਕਲਰ ਹੀ ਲੈਂਦੀ ਹਾਂ ਫਿੱਕੇ ਕਲਰ ਹੀ ਨਾਲੇ ਗਰਮੀ ਦੇ ਵਿੱਚ ਤਾਂ ਵੈਸੇ ਹੀ ਫਿੱਕੇ ਕਲਰ ਪਾਉਣੇ ਚਾਹੀਦੇ ਆ ਅਤੇ ਪਾਏ ਸੋਹਣੇ ਵੀ ਲੱਗਦੇ ਆ ਕੋਈ ਵੀ ਫਿੱਕੇ ਕਲਰ ਜ਼ਰੂਰ ਯੂਜ ਕਰਨੇ ਚਾਹੀਦੇ ਅਤੇ ਮੈਂ ਜੋ ਪਾਉਂਦੀ ਹਾਂ ਆਪਦੇ ਦਿਮਾਗ ਦੇ ਨਾਲ ਵੀ ਮੈਂ ਦਿਮਾਗ ਖਰਚ ਕਰਕੇ ਵੀ ਫਿੱਕਾ ਕਲਰ ਹੀ ਫੈਟ ਹੋ ਗਿਆ ਪਿੰਕ ਹੋ ਗਿਆ ਸਰਤਈ ਹੋ ਗਿਆ ਅਤੇ ਇਹੋ ਜਿਹੇ ਕਲਰ ਮੈਂ ਆਪਦਾ ਪਾਉਂਦੀ ਹਾਂ ਅਤੇ ਇਹੀ ਮੈਨੂੰ ਚੰਗੇ ਲੱਗਦੇ ਨੇ ਮੇਰੇ ਮਨ ਨੂੰ ਅਤੇ ਗੂੜ੍ਹੇ ਕਲਰ ਨਹੀਂ ਚੰਗੇ ਲੱਗਦੇ